ਮੇਰੇ ਜੱਦੀ ਪਿੰਡ ਬਾਰੇ ਮੇਰੀ ਮਨਪਸੰਦ ਚੀਜ਼ ਇਹੀ ਹੈ ਕਿ ਜਿਹੜਾ ਮੇਰਾ ਪਿੰਡ ਹੈ ਉਹਦੇ ਨੇੜੇ ਤੇੜੇ ਹਰੇਕ ਤਰ੍ਹਾਂ ਦੀ ਦੁਕਾਨ ਹੈ ਮਤਲਬ ਕਿ ਪੂਰੀ ਇੱਕ ਵੱਡੀ ਮਾਰਕਿਟ ਬਣੀ ਹੋਈ ਹੈ ਛੋਟੇ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਤੱਕ ਦੀ ਸਾਰੀਆਂ ਦੀਆਂ ਦੁਕਾਨਾਂ ਹਨ ਅਤੇ ਜੇਕਰ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਤਾਂ ਬਸ ਅਸੀਂ ਤੁਰ ਕੇ ਪੰਜ ਮਿੰਟ ਦੇ ਵਿੱਚ ਮਾਰਕਿਟ ਦੇ ਵਿੱਚ ਪਹੁੰਚ ਜਾਂਦੇ ਹਾਂ ਜਿਹੜੀ ਮੁੱਖ ਮਾਰਕਿਟ ਹੈ ਅਤੇ ਉਹਦੇ ਵਿੱਚ ਜਿਹੜੀ ਵੀ ਚੀਜ਼ ਸਾਨੂੰ ਲੈਣੀ ਹੁੰਦੀ ਹੈ ਅਸੀਂ ਉਹ ਚੀਜ਼ ਆਸਾਨੀ ਨਾਲ਼ ਸਾਨੂੰ ਮਿਲ ਜਾਂਦੀ ਹੈ ਅਤੇ ਬਿਲਕੁਲ ਠੀਕ ਰੇਟ 'ਤੇ ਇਹ ਨਹੀਂ ਹੈ ਕਿ ਕਿ ਇਸ ਜਗ੍ਹਾ ਪਿੰਡ ਦੀ ਸਾਰੀ ਮਾਰਕਿਟ ਇੱਥੇ ਮਹਿੰਗੀ ਹੋਏਗੀ ਚੀਜ਼ ਨਹੀਂ ਜੋ ਵੀ ਉਹਦਾ ਸਹੀ ਮੁੱਲ ਹੁੰਦਾ ਹੈ ਸਾਨੂੰ ਉਸੀ ਕੀਮਤ 'ਤੇ ਉਹ ਚੀਜ਼ ਮਿਲਦੀ ਹੈ ਅਤੇ ਬਾਕੀ ਪਿੰਡਾਂ ਦੇ ਲੋਕ ਵੀ ਜੇ ਕੁਛ ਸਮਾਨ ਲੈਣਾ ਹੁੰਦਾ ਤਾਂ ਸਾਡੇ ਪਿੰਡ ਹੀ ਆਉਂਦੇ ਹਨ ਅਤੇ ਕੋਈ ਵੀ ਚੀਜ਼ ਚਾਹੇ ਛੋਟੀ ਚੀਜ਼ ਹੋਵੇ ਚਾਹੇ ਵੱਡੀ ਚੀਜ਼ ਹੋਵੇ ਕਿਸੇ ਵੀ ਚੀਜ਼ ਨੂੰ ਲੈਣ ਲਈ ਸਾਨੂੰ ਆਪਣੇ ਪਿੰਡ ਤੋਂ ਬਾਹਰ ਕਿਤੇ ਹੋਰ ਸ਼ਹਿਰ ਵ ਜਾਂ ਟਾਊਨ ਕਲੋਨੀ ਵੱਲ ਕਿਤੇ ਜਾਣਾ ਨਹੀਂ ਪੈਂਦਾ ਕਿਉਂਕਿ ਸਾਨੂੰ ਸਾਰੀ ਚੀਜ਼ਾਂ ਸਾਡੇ ਮ ਮੇਰੇ ਪਿੰਡ ਦੇ ਵਿੱਚ ਹੀ ਮਿਲ ਜਾਂਦੀ ਹੈ ਅਤੇ ਅਤੇ ਮੇਰੇ ਪਿੰਡ ਦੇ ਵਿੱਚ ਇਹ ਸਭ ਤੋਂ ਬਹੁਤ ਵਧੀਆ ਚੀਜ਼ ਹੈ ਅਤੇ ਮੇਰੇ ਪਿੰਡ ਦੇ ਨੇੜੇ ਹੀ ਸਰਕਾਰੀ ਸਕੂਲ ਵੀ ਹੈ ਪ੍ਰਾਈਵੇਟ ਸਕੂਲ ਵੀ ਹੈ ਕੋਲੇਜ ਵੀ ਹੈ ਯੂਨੀਵਰਸਿਟੀ ਵੀ ਹੈ ਹੋਸਪੀਟਲ ਵੀ ਹੈ ਬੈਂਕ ਹੈ ਮਤਲਬ ਮੇਰੇ ਪਿੰਡ ਦੇ ਨੇੜੇ ਦਸ ਜਾਂ ਪੰਜ ਮਿੰਟ ਦੇ ਰਸਤੇ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਉਪਲੱਬਧ ਨੇ ਜਿਹਦੇ ਕਰਕੇ ਸਾਡੇ ਪਿੰਡ ਦੇ ਕਿਸੇ ਬੱਚੇ ਨੂੰ ਪੜ੍ਹਨ ਲਈ ਪਲੱਸ ਵਨ ਪਲੱਸ ਟੂ ਕਰਨ ਲਈ ਬਾਹਰ ਨਹੀਂ ਜਾਣਾ ਪੈਂਦਾ ਪਿੰਡ ਤੋਂ ਪੜ੍ਹਾਈ ਕਰਨ ਲਈ ਬੀਏ ਬੀਐਡ ਬੀਕੋਮ ਵਗੈਰਾ ਕਰਨ ਲਈ ਕਿਤੇ ਬਾਹਰ ਨਹੀਂ ਜਾਣਾ ਪੈਂਦਾ ਅਤੇ ਸਾਡੇ ਸਕੂਲ ਦੇ ਵਿੱਚ ਜਿਹੜਾ ਸਕੂਲ ਆ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਹੈ ਇਸ ਕਰਕੇ ਬੱਚੇ ਨੂੰ ਪੜ੍ਹਨ ਵਿੱਚ ਜਾਂ ਕੁਝ ਨਵਾਂ ਸਿੱਖਣ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ